ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਹਾਂਜੀ ਕੀ ਚੀਜ਼ ਆ ਜੀ ਅੱਛਾ ਜੀ ਠੀਕ ਠੀਕ ਹੈ ਜੀ ਇਹ ਕੀ ਉਹਦੇ ਵਿੱਚ ਤੁਸੀਂ ਮਤਲਬ ਬੋਕਸ ਵਾਲੇ ਬੈੱਡ ਬਣਾਉਣੇ ਆ ਜਾਂ ਦੂਜੇ ਸਿੰਪਲ ਆ ਜੀ

ਠੀਕ ਆ ਜੀ ਜਿੱਦਾਂ ਮਾਈਕਾ ਮੁਈਕਾ ਉੱਪਰ ਲਾ ਦਈਏ ਹੈ ਨਾ ਜੀ ਅਤੇ ਪਿੱਛੇ ਢੋਹ ਵੀ ਬਣਾਉਣਾ ਵੀਰੇ ਠੀਕ ਹੈ ਜੀ ਅਤੇ ਉਹਨੂੰ ਪੋਲਿਸ਼ ਵਗੈਰਾ ਜਿਹੜੇ ਅੱਜ ਕੱਲ੍ਹ ਚੱਲਦੇ ਆ ਅਤੇ

ਠੀਕ ਹੈ ਜੀ ਅਤੇ ਡਾਈਨਿੰਗ ਟੇਬਲ ਛੇ ਕੁਰਸੀਆਂ ਵਾਲਾ ਆ ਜਾਂ ਕਿੱਦਾਂ ਛੋਟਾ ਆ ਠੀਕ ਹੈ ਜੀ ਇੱਕ ਤਾਂ ਵੀਰ ਖਰਚਾ ਤਾਂ ਚਲੋ ਜੋ ਆਪਾਂ ਲਵਾਂਗੇ ਇੱਕ ਇਹਨਾਂ ਦੀ ਹਾਲਤ ਦੇਖਣੀ ਪੈਣੀ ਆਪਾਂ ਨੂੰ ਕਿੱਦਾਂ ਦੀ ਹਾਲਤ 'ਚ ਹੈ ਕੀ ਕੀ ਚੀਜ਼ ਉੱਤੇ ਲੱਗੇਗੀ ਅਤੇ ਜਿਹੜਾ ਆਪਣਾ ਹੈਗਾ ਡਾਇਨਿੰਗ ਟੇਬਲ ਉਹਦੇ ਉੱਪਰ ਵੀ ਅੱਜ ਕੱਲ੍ਹ ਮਾਈਕਾ ਆਉਂਦਾ ਹੈ ਇੱਕ ਉਹ ਵੀ ਲੱਗ ਜਾਂਦਾ ਔਰ ਉਹਦੇ ਉੱਤੇ ਗਲਾਸ ਵੀ ਆ ਜਾਂਦਾ ਜਿੱਦਾਂ ਰਾਊਂਡ ਸ਼ੇਪ 'ਚ ਉਹਨੂੰ ਕੱਟ ਕੇ ਜਾਂ ਦੂਜਾ ਚੋਰਸ ਵੀ ਜਿਹੜਾ ਹੁੰਦਾ ਹੈ ਨਾ ਜੀ ਸਾਈਡਾਂ ਤੋਂ ਗਿਲਾਸ ਜਿੱਦਾਂ ਆ ਜਾਂਦਾ ਉਹ ਜਿਹੜਾ ਉੱਪਰ ਮਾਈਕਾ ਲੱਗਾ ਹੁੰਦਾ ਜਾਂ ਕੱਪੜਾ ਉਹ ਫਿਰ ਟੇਬਲ ਦੀ ਪਰਤ ਆ ਉਹ ਜਿਹੜੀ ਖਰਾਬ ਨਹੀਂ ਹੁੰਦੀ ਕੋਈ ਬੱਚਾ ਕੋਈ ਚੀਜ਼ ਗਿਰਾ ਦੇਵੇ ਉੱਤੇ ਜਾਂ ਕਿੱਦਾਂ ਅਤੇ

ਇਹਨੂੰ ਦੱਸ ਦਿਉ ਤੁਸੀਂ ਕਦੋਂ ਡਿਊਟੀ ਵਗੈਰਾ ਜਾਂਦੇ ਹਾਂ ਮੈਂ ਆਪਣੇ ਲੜਕੇ ਨੂੰ ਭੇਜ ਦੇਵਾਂਗਾ ਜੀ ਅਤੇ ਉਹ ਇੱਕ ਅੱਜ ਹੀ ਜੀ ਕੋਈ ਨਹੀਂ ਭੇਜ ਦਿੰਦਾ ਮੈਂ ਉਹਦੇ ਹੱਥ ਬੁੱਕ ਵੀ ਭੇਜ ਦੇਵਾਂਗਾ ਉਹ 'ਚ ਤੁਸੀਂ ਆਪਣਾ ਡਿਜ਼ਾਇਨ ਵੀ ਸਲੈਕਟ ਕਰ ਲਿਓ ਮੈਂ ਭੇਜ ਦੇਵਾਂਗਾ ਛੇ ਕੁ ਵਜੇ ਛੇ ਕੁ ਵਜੇ ਦੇ ਕਰੀਬ ਜੀ ਅਤੇ ਆਪਣਾ ਕੀ ਓ ਓਕੇ ਜੀ